ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਵਿੱਚ ਵਿਸਾਖੀ ਦੀ ਬਹੁਤ ਹੀ ਮਹੱਤਤਾ ਹੈ ਇਸ ਨੂੰ ਬਹੁਤ ਹੀ ਮਹੱਤਵਪੂਰਨ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ ਇਹ ਪੰਜਾਬ ਵਿੱਚ ਵਾਢੀ ਦੇ ਮੌਸਮ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਅਤੇ ਖ਼ਾਸ ਕਰਕੇ ਸਿੱਖਾਂ ਲਈ ਬਹੁਤ ਹੀ ਧਾਰਮਿਕ ਅਤੇ ਇਤਿਹਾਸਿਕ ਮਹੱਤਤਾ ਰੱਖਦਾ ਹੈ ਇੱਥੇ ਵਿਸਾਖੀ ਦੀ ਮਹੱਤਤਾ ਇਸ ਨੂੰ ਅਸੀਂ ਇਸ ਤਰ੍ਹਾਂ ਜਾਣਦੇ ਹਾਂ ਜਿਵੇਂ ਵਾਢੀ ਦਾ ਤਿਉਹਾਰ ਜਿਹੜਾ ਖੇਤੀਬਾੜੀ ਲਈ ਬਹੁਤ ਹੀ ਮਹੱਤਤਾ ਰੱਖਦਾ ਹੈ ਵਿਸਾਖੀ ਰਿਵਾਇਤੀ ਤੌਰ 'ਤੇ ਹਾੜੀ ਦੀਆਂ ਫਸਲਾਂ ਮੁੱਖ ਤੌਰ 'ਤੇ ਕਣਕ ਦੀ ਵਾਢੀ ਮਨਾਉਂਦੀ ਹੈ ਜੋ ਕਿ ਪੰਜਾਬ ਦਾ ਮੁੱਖ ਭੋਜਨ ਹੈ ਪੰਜਾਬ ਦੇ ਕਿਸਾਨ ਭਾਈਚਾਰੇ ਲਈ ਇਹ ਇੱਕ ਭਰਪੂਰ ਵਾਢੀ ਲਈ ਪਰਮਾਤਮਾ ਦਾ ਧੰਨਵਾਦ ਕਰਨ ਅਤੇ ਭਵਿੱਖ ਦੀ ਖੁਸ਼ਹਾਲੀ ਲਈ ਪ੍ਰਾਰਥਨਾ ਕਰਨ ਦਾ ਸਮਾਂ ਹੈ ਇਸ ਲਈ ਸੱਭਿਆਚਾਰਕ ਜਸ਼ਨ ਵੀ ਕੀਤੇ ਜਾਂਦੇ ਹਨ ਇੱਕ ਖੇਤੀ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ ਵਿਸਾਖੀ ਪੰਜਾਬ ਦੇ ਜੀਵੰਤ ਪੇਂਡੂ ਜੀਵਨ ਨੂੰ ਦਰਸਾਉਂਦੀ ਹੈ ਸੰਗੀਤ ਨਾਚ ਅਤੇ ਦਾਵਤ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਭੰਗੜਾ ਗਿੱਧਾ ਵੀ ਕੀਤਾ ਜਾਂਦਾ ਹੈ ਵਿਸਾਖੀ ਲਈ ਬਹੁਤ ਸਾਰੇ ਕਈ ਜਗ੍ਹਾ 'ਤੇ ਮੇਲੇ ਵੀ ਲੱਗਦੇ ਹਨ ਸਾਡੇ ਬਰਨਾਲੇ ਦੇ ਵਿੱਚ ਵੀ ਇੱਕ ਬਹੁਤ ਹੀ ਭਾਰੀ ਭਰਪੂਰ ਮੇਲਾ ਲੱਗਦਾ ਹੈ ਜਿਸ ਵਿੱਚ ਬੰਦਿਆਂ ਦਾ ਬੱਚਿਆਂ ਦਾ ਅਤੇ ਬਜ਼ੁਰਗਾਂ ਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ ਬੱਚੇ ਮਿਠਾਈਆਂ ਖਰੀਦਦੇ ਝੂਲੇ ਲੈਂਦੇ ਹਨ ਅਤੇ ਮਨੋਰੰਜਨ ਕਰਦੇ ਹਨ ਵਿਸਾਖੀ ਦਾ ਤਿਉਹਾਰ ਸਾਡੇ ਪੰਜਾਬੀਆਂ ਲਈ ਸਭ ਤੋਂ ਹੀ ਮਹੱਤਵਪੂਰਨ ਤਿਉਹਾਰ ਹੁੰਦਾ ਹੈ ਇਸ ਦਾ ਇੱਕ ਇਤਿਹਾਸਿਕ ਵੀ ਹੈ ਇਸ ਦਿਨ ਬਹੁਤ ਹੀ ਖੇਤੀ ਨਾਲ ਸੰਬੰਧਿਤ ਹੈ ਇਸ ਦਿਨ ਉਹ ਬਹੁਤ ਹੀ ਰ ਰੀਝ ਨਾਲ ਸਾਰੇ ਬੱਚੇ ਬਜ਼ੁਰਗ ਸੋਹਣੇ ਸੋਹਣੇ ਤਿਆਰ ਹੋ ਕੇ ਮੇਲਿਆਂ ਵਿੱਚ ਜਾਂਦੇ ਹਨ ਅਤੇ ਆਨੰਦ ਮਾਣਦੇ ਹਨ ਇਹ ਤਿਉਹਾਰ ਖੇਤੀ ਦੀ ਫਸਲ ਫਸਲਾਂ ਦੇ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਇਸ ਨੂੰ ਸੱਭਿਆਚਾਰਕ ਤੌਰ 'ਤੇ ਵੀ ਮਨਾਇਆ ਜਾਂਦਾ ਹੈ ਬੰਦੇ ਘੋਲ ਵੀ ਕਰਦੇ ਹਨ ਅਤੇ ਲੋਕ ਵੱਧ ਚੜ ਕੇ ਹਿੱਸਾ ਵੀ ਲੈਂਦੇ ਹਨ ਅਤੇ ਉਹਨਾਂ ਨੂੰ ਦੇਖ ਕੇ ਆਪਣਾ ਮਨੋਰੰਜਨ ਵੀ ਕਰਦੇ ਹਨ ਬੱਚਿਆਂ ਦਾ ਉਤਸ਼ਾਹ ਦੇਖਣ ਵਾਲਾ ਹੁੰਦਾ ਹੈ ਛੋਟੇ ਛੋਟੇ ਬੱਚੇ ਵੀ ਭੰਗੜਾ ਗਿੱਧਾ ਆਦਿ ਪੇਸ਼ ਕਰਦੇ ਹਨ ਅਤੇ ਆਪਣਾ ਮਨੋਰੰਜਨ ਕਰਦੇ ਹਨ ਧੰਨਵਾਦ